ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਅਵੀ ਦੀ ਕਲਾਸ ਟੀਚਰ ਬੋਲ ਰਹੀ ਹਾਂ ਹਾਂਜੀ ਮੈਮ ਐਕਚੁਲੀ ਨਾ ਇਹਨਾਂ ਦਾ ਸਕੂਲ ਵੱਲੋਂ ਇੱਕ ਟਰਿੱਪ ਜਾ ਰਿਹਾ ਵੰਡਰਲੈਂਡ ਮੈਂ ਬਸ ਇੱਕ ਕੰਫਰਮੇਸ਼ਨ ਚਾਹੁੰਦੀ ਸੀ ਤੁਸੀਂ ਆਪਣੇ ਬੱਚੇ ਨੂੰ ਇਸ ਟਰਿੱਪ 'ਤੇ ਭੇਜਣਾ ਚਾਹੋਗੇ ਓਕੇ ਮੈਮ ਮੈਮ ਇਹਦੀ ਵਨ ਥਾਉਸੰਡ ਫੀਸ ਹੈਗੀ ਹੈ ਮੈਮ ਇਹ ਜਾ ਰਿਹਾ ਹੈ ਏਟੀਨ ਮੇਈ ਕੋ ਮੈਮ ਇਹਦੀ ਟਾਈਮਿੰਗ ਬੱਚਿਆਂ ਨੂੰ ਅਰਲੀ ਮੋਰਨਿੰਗ ਤੁਹਾਨੂੰ ਛੇ ਵਜੇ ਮਤਲਬ ਸਕੂਲ ਛੱਡਣਾ ਪਏਗਾ ਬੱਚੇ ਨੂੰ ਅਤੇ ਛੇ ਵਜੇ ਹੀ ਇਹ ਪੁੱਜ ਜਾਣਗੇ ਸਕੂਲ ਅਤੇ ਉੱਥੋਂ ਤੁਸੀਂ ਪਿਕ ਕਰਕੇ ਲੈ ਸਕਦੇ ਹੋ ਨਹੀਂ ਨਹੀਂ ਮੈਮ ਸਕੂਲ ਦੀ ਬੱਸਿਸ ਹੀ ਹੋਣਗੀਆਂ ਜਿਵੇਂ ਮੈਮ ਖਾਣ ਪੀਣ ਲਈ ਇਹਨਾਂ ਦਾ ਅਰੈਂਜਮੈਂਟ ਪ੍ਰੋਪਰ ਹੋਏਗਾ ਇਹਨਾਂ ਨੂੰ ਸੁਬੇ ਬ੍ਰੇਕਫਾਸਟ ਵਗੈਰਾ ਲੰਚ ਹੋਏਗਾ ਇਹਨਾਂ ਦਾ ਅਗਰ ਤੁਸੀਂ ਅਲੱਗ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਹਨਾਂ ਲਈ ਕੁਛ ਸਨੈਕਸ ਵਗੈਰਾ ਭੇਜਣੇ ਆ ਤਾਂ ਭੇਜ ਸਕਦੇ ਹੋ ਨਹੀਂ ਨਹੀਂ ਮੈਮ ਉਹ ਕੋਈ ਨਹੀਂ ਜ਼ਰੂਰਤ ਨਹੀਂ ਹੈਗੀ ਹਾਂਜੀ ਮੈਮ ਉਹ ਤੇ ਜਾਂਦੇ ਪਏ ਆ ਮੈਂ ਦੋ ਤਿੰਨ ਦੇ ਪੇਰੈਂਟਸ ਨੂੰ ਕੋਲ ਕੀਤੀ ਆ ਉਨ੍ਹਾਂ ਨੇ ਉਹ ਐਗਰੀ ਹੋ ਗਏ ਨੇ ਹਾਂਜੀ ਹਾਂਜੀ ਮੈਮ ਥੈਂਕਯੂ ਓਕੇ ਧੰਨਵਾਦ ਜੀ